ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਤਰ੍ਹਾਂ ਦੇ ਹਸਪਤਾਲ ਹਨ ਕੁਝ ਹਸਪਤਾਲ ਸਰਕਾਰੀ ਹਨ ਅਤੇ ਕੁਝ ਹਸਪਤਾਲ ਪ੍ਰਾਈਵੇਟ ਹਨ ਦੋਨੋਂ ਹਸਪਤਾਲ ਇੱਕੋ ਬਰਾਬਰ ਹਨ ਸਰਕਾਰੀ ਹਸਪਤਾਲ ਦੀ ਗੱਲ ਕਰੀਏ ਤਾਂ ਉੱਥੇ ਵੀ ਡੋਕਟਰਸ ਬਹੁਤ ਵਧੀਆ ਹਨ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਵੀ ਡੋਕਟਰਸ ਬਹੁਤ ਵਧੀਆ ਹਨ ਅੱਛੀ ਤਰ੍ਹਾਂ ਦੇਖਭਾਲ ਕਰਦੇ ਹਨ ਪੇਸ਼ੈਂਟਸ ਦੀ ਅਤੇ ਉਹਨਾਂ ਨੂੰ ਟਾਈਮ ਟੂ ਟਾਈਮ ਦਵਾਈ ਵੀ ਦਿੰਦੇ ਆ ਅੱਛੀ ਤਰ੍ਹਾਂ ਬਿਲਕੁਲ ਵਧੀਆ ਚਲਦਾ ਸਭ ਕੁਝ ਅਤੇ ਅਗਰ ਆਪਾਂ ਗੱਲ ਕਰੀਏ ਕੋਵਿਡ ਦੀ ਤਾਂ ਉਸ ਟਾਈਮ ਬਹੁਤ ਜ਼ਿਆਦਾ ਮਹਾਮਾਰੀ ਫੈਲ ਗਈ ਸੀ ਅਤੇ ਫਿਰ ਉਸ ਟਾਈਮ ਵੀ ਡੋਕਟਰਸ ਨੇ ਬਹੁਤ ਅੱਛੀ ਤਰ੍ਹਾਂ ਦੇਖਭਾਲ ਕੀਤੀ ਸਾਰੇ ਪੇਸ਼ੈਂਟਸ ਦੀ ਜਿਹੜੇ ਉਹਨਾਂ ਦੇ ਕਮਰੇ ਸੀਗੇ ਬਿਲਕੁਲ ਅੱਛੀ ਤਰ੍ਹਾਂ ਸੈਨੀਟਾਈਜ਼ ਹੁੰਦੇ ਸ ਹੁੰਦੇ ਸੀ ਅਤੇ ਉੱਥੇ ਸਫਾਈ ਵੀ ਬਹੁਤ ਵਧੀਆ ਹੁੰਦੀ ਸੀ ਟਾਈਮ ਟੂ ਟਾਈਮ ਉਹਨਾਂ ਨੂੰ ਦਵਾਈ ਦਿੱਤੀ ਜਾਂਦੀ ਸੀ ਇੰਜੈਕਸ਼ਨਸ ਦਿੱਤੇ ਜਾਂਦੇ ਸੀ ਅਤੇ ਉਹਨਾਂ ਦਾ ਜਿਹੜਾ ਖਾਣ ਪੀਣ ਦਾ ਧਿਆਨ ਰੱਖਿਆ ਜਾਂਦਾ ਸੀ ਅੱਛਾ ਉਹਨਾਂ ਨੂੰ ਡਾਇਟ ਦਿੱਤੀ ਜਾਂਦੀ ਸੀ